ਹੈਲੋ ਸਰ ਫਲਿੱਪਕਾਡ 'ਚੋਂ ਬੋਲਦੇ ਹੋ ਮੈਂ ਇੱਕ ਕੰਪਲੇਟ ਕਰਨੀ ਸੀ ਦਰਅਸਲ ਮੈਂ ਪਿਛਲੀ ਦਸ ਤਰੀਕ ਨੂੰ ਫਲਿੱਪਕਾਡ ਤੋਂ ਹੈਡਫੋਨ ਆਡਰ ਆਡਰ ਕੀਤੇ ਸਨ ਅਤੇ ਇੱਕ ਤਾਂ ਉਹ ਹੈਡਫੋਨ ਮੇਰੇ ਕੋਲ ਡਿਲੀਵਰੀ ਡੇਟ ਤੋਂ ਆਏ ਹੀ ਤਿੰਨ ਚਾਰ ਦਿਨ ਲੇਟ ਅਤੇ ਉੱਪਰੋਂ ਮੈਂ ਹੈਡਫੋਨ ਮੰਗਵਾਏ ਐਪਲ ਦੇ ਸੀ ਅਤੇ ਮੇਰੇ ਕੋਲ ਆਏ ਸੈਮਸੰਗ ਦੇ ਅਤੇ ਜਿਹੜੀ ਪੈਕਿੰਗ ਵਿੱਚ ਆਏ ਉਹ ਪੈਕਿੰਗ ਵੀ ਖੋਲੀ ਅਤੇ ਫਟੀ ਹੋਈ ਸੀ ਜਿਹੜਾ ਡਿਲੀਵਰੀ ਬੋਆਏ ਆਇਆ ਮੈਂ ਉਹਦੇ ਅੱਗੇ ਹੀ ਹੈਡਫੋਨ ਓਪਨ ਕੀਤੇ ਸੀਗੇ ਅਤੇ ਮੈਂ ਵੀਡੀਓ ਵੀ ਰਿਕਾਰਡ ਕਰ ਲਈ ਸੀ ਅਤੇ ਮੇਰੇ ਕੋਲ ਮੇਰੇ ਹ ਸਬੂਤ ਹਨ ਅਤੇ ਮੈਂ ਦੋ ਵਾਰ ਕੰਪਲੇਂਟ ਵੀ ਕਰ ਦਿੱਤੀ ਕਿਰਪਾ ਕਰਕੇ ਮੈਨੂੰ ਐਪਲ ਦੇ ਹੈਡਫੋਨ ਦਿੱਤੇ ਜਾਣ ਜਾਂ ਫਿਰ ਮੇਰੇ ਪੈਸੇ ਵਾਪਸ ਕੀਤੇ ਜਾਣ ਧੰਨਵਾਦ